ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਕਿਹੜੇ ਐਕਟਰ ਨੇ ਜਿਨ੍ਹਾਂ ਨੇ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੋਇਆ ਤੁਸੀਂ ਦੱਸ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਅੱਛਾ ਹੋਰ ਮਤਲਬ ਇਹਨਾਂ ਬਾਰੇ ਕੁਝ ਤੁਹਾਨੂੰ ਜਾਣਕਾਰੀ ਹੋਵੇ ਦੱਸ ਸਕਦੇ ਹੋ ਦੱਸੋ

ਹਾਂਜੀ ਹਾਂਜੀ ਠੀਕ ਹੈ ਹੋਰ ਵੀ ਦੱਸੋ ਕੁਛ ਇਹਨਾਂ ਬਾਰੇ ਤੁਹਾਨੂੰ ਇਹਨਾਂ 'ਚ ਕੀ ਚੰਗਾ ਲੱਗਦਾ ਵਾ ਐਕਟ ਹਾਂਜੀ

ਹਾਂਜੀ ਹਾਂਜੀ ਠੀਕ ਹੈ ਹੋਰ ਹੋਰ ਵੀ ਦੱਸੋ ਥੋੜ੍ਹਾ ਜਿਹਾ ਹੋਰ ਵੀ ਕੋਈ ਯਾਦ ਕਰਕੇ ਦੱਸ ਦਿਓ ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਹਾ ਹਾਂਜੀ ਹਾਂਜੀ ਹਾਂਜੀ ਅਸੀਂ ਸੰਤੁਸ਼ਟ ਹਾਂ ਹਾਂਜੀ ਬਹੁਤ ਵਧੀਆ ਲੱਗਦਾ ਗੱਲ ਕਰਕੇ ਹਾਂਜੀ ਬਹੁਤ ਵਧੀਆ ਲੱਗਿਆ ਓਕੇ